ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਸੋਨੂੰ ਸੂਜ਼ ਸ਼ਾਪ ਤੋਂ ਬੋਲਦੇ ਜੀ ਹਾਂਜੀ ਮੈਮ ਆਪਾਂ ਨੂੰ ਬੂਟ ਚਾਹੀਦੇ ਸੀਗੇ ਕਿਹੜੀ ਕਿਹੜੀ ਕੋਂਪਣੀ ਦੇ ਆਪਣੇ ਕੋਲ ਸ਼ੂ ਹੁੰਦੇ ਨੇ ਮੈਮ ਫੋਰਮਲ ਚਾਹੀਦੇ ਜੀ ਆਪਾਂ ਨੂੰ ਹਾਂਜੀ ਮੈਰਿਜ 'ਤੇ ਮੈਰਜ 'ਤੇ ਜਾਣ ਲਈ ਆਪਾਂ ਨੂੰ ਫੋਰਮਲ ਚਾਹੀਦੇ ਜੀ ਟੈਨ ਕਲਰ ਹੋਵੇ ਆਪਣਾ ਕੋਫੀ ਕਲਰ ਹੋਵੇ ਠੀਕ ਹੈ ਮੈਮ ਠੀ ਕਿਹੜੀ ਕਿਹੜੀ ਕਿਹੜੀ ਕੈਟਾਗਰੀ ਦੇ ਹੁੰਦੇ ਜੀ ਫੇਰ ਆਪਣੇ ਕੋਲ ਸ਼ੂਜ਼ ਓਕੇ ਓਕੇ ਮੈਮ ਸਾਡੇ ਇੱਥੇ ਸਾਡੇ ਸਾਡੇ ਨੌਨ ਸੀਗੇ ਤੁਹਾਡੇ ਤੋਂ ਪਹਿਲਾਂ ਲੈ ਕੇ ਗਏ ਸੀਗੇ ਅਤੇ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਉੱਥੇ ਵਧੀਆ ਰੇਂਜ਼ ਦੇ ਵਿੱਚ ਸ਼ੂਜ਼ ਮਿਲ ਜਾਂਦੇ ਨੇ ਵੀ ਵਧੀਆ ਕੋਂਪਣੀ ਦੇ ਹੁੰਦੇ ਨੇਗੇ ਰੇਂਜ ਕਿੱਥੋਂ ਕਿੱਥੋਂ ਤੱਕ ਸਟਾਰਟ ਹੁੰਦੇ ਮੈਡਮ ਰੇਂਜ ਹਾਂਜੀ ਕੁ ਬਸ ਕੁਵਾਲਟੀ ਵਧੀਆ ਹੋਵੇ ਜੀ ਰੇਟ ਆਪਾਂ ਨੂੰ ਦੇਖ ਕੇ ਲਾਇਓ ਠੀਕ ਹੈ ਠੀਕ ਹੈ ਜੀ ਆਪਾਂ ਸਾਰੇ ਨੰਬਰ ਮਿਲ ਜਾਣਗੇ ਜੀ ਬੂਟ ਹੈ ਨਾ ਸਾਰੇ ਸਾਈਜ਼ ਮਿਲ ਜਾਣਗੇ

ਮੈਡਮ ਮੇਰਾ ਦਸ ਵੀ ਆ ਜਾਂਦਾ ਜੀ ਅਤੇ ਨੌ ਵੀ ਆ ਜਾਂਦਾ ਅਲੱਗ ਅਲੱਗ ਬ੍ਰਾਂਡ ਦਾ ਮੇਰਾ ਅਲੱਗ ਅਲੱਗ ਸਾਈਜ਼ ਹੈ ਜੀ ਠੀਕ ਹੈ ਠੀਕ ਹੈ ਮੈਡਮ ਸਾਰੇ ਬ੍ਰਾਂਡ ਦੇ ਹੁੰਦੇ ਮੈਡਮ ਆਪਣੇ ਕੋਲ ਪੂਮਾ ਦੇ ਹੋ ਗਏ ਠੀਕ ਹੈ ਠੀਕ ਹੈ ਜੀ ਮੈਡਮ ਕੱਲ ਕੱਲ ਨੂੰ ਮੋਰਨਿੰਗ ਜਾਂ ਸ਼ਾਮੀ ਅਸੀਂ ਆਵਾਂਗੇ ਹਾਂ ਠੀਕ ਆਪਣੀ ਸ਼ੌਪ ਕਿੱਥੇ ਜੇ ਰਹਿ ਜਾਂਦੀ ਮੈਡਮ ਇਹ ਸਦਰ ਬਜ਼ਾਰ 'ਚ ਕਿੱਥੇ ਕੁ ਰਹਿ ਜਾਂਦੀ ਜੀ ਅੱਛਾ ਅੱਛਾ ਜੀ ਉੱਥੋਂ ਆਪਣੇ ਰੇਲਵੇ ਸਟੇਸ਼ਨ ਤੋਂ ਸਦਰ ਬਜ਼ਾਰ ਨੂੰ ਆ ਕੇ ਅੱਗੇ ਜਾ ਕੇ ਆਪਣਾ ਦਾਦੂ ਸ਼ੋਪ ਤੋਂ ਰਾਈਟ ਸਾਈਡ ਮੁੜਨਾ ਜਾਂ ਲੈਫਟ ਸਾਈਡ ਜੀ ਠੀਕ ਹੈ ਠੀਕ ਹੈ ਉੱਥੇ ਸਾਹਮਣੇ ਹੋਊ ਆਪਣੀ ਸ਼ੋਪ ਜੀ ਇਹ ਠੀਕ ਹੈ ਠੀਕ ਹੈ ਮੈਡਮ ਫਿਰ ਅਸੀਂ ਮੋਰਨਿੰਗ ਟਾਈਮ ਆਵਾਂਗੇ ਠੀਕ ਹੈ ਥੈਂਕ ਯੂ ਮੈਮ